ਮੈਨੂੰ ਆਪਣੇ ਮੋਬਾਈਲ ਫੋਨ 'ਤੇ ਰੀਚਾਰਜ ਖਤਮ ਹੋਣ ਦਾ ਮੈਸਿਜ ਆਇਆ ਤਾਂ ਮੈਂ ਜਲਦੀ ਹੀ ਆਪਣੇ ਦੋਸਤ ਨਾਲ ਗੱਲ ਕੀਤੀ ਕਿਉਂਕਿ ਮੈਨੂੰ ਆਪਣੇ ਮੋਬਾਈਲ ਫੋਨ 'ਤੇ ਰੀਚਾਰਜ ਕਰਨ ਬਾਰੇ ਬਹੁਤ ਘੱਟ ਜਾਣਕਾਰੀ ਸੀ ਤਾਂ ਉਸ ਨੇ ਮੈਨੂੰ ਦੱਸਿਆ ਕਿ ਇੱਕ ਮਹੀਨੇ ਦਾ ਰੀਚਾਰਜ ਢਾਈ ਸੌ ਰੁਪਏ ਵਿੱਚ ਅਤੇ ਤਿੰਨ ਮਹੀਨਿਆਂ ਦਾ ਰੀਚਾਰਜ ਸੱਤ ਸੌ ਰੁਪਏ ਵਿੱਚ ਹੈ ਤਾਂ ਮੈਂ ਇਨ੍ਹਾਂ ਸਾਰੀਆਂ ਹਦਾਇਤਾਂ ਲੈਣ ਤੋਂ ਬਾਅਦ ਆਪਣੇ ਫੋਨ ਦਾ ਰੀਚਾਰਜ ਕਰਵਾਇਆ